ਮੈਂ ਤੁਹਾਨੂੰ ਇੱਕ ਬਾਈਕਰ ਵਜੋਂ ਆਪਣੀਆਂ ਜੋ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਮੈਨੂੰ ਸਾਹਮਣਾ ਕਰਨਾ ਕਹਿੰਦਾ ਹੈ ਉਸ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਵਿੱਚੋਂ ਪ੍ਰਮੁੱਖ ਚੁਣੌਤੀਆਂ ਇਹ ਹਨ ਅੱਜ ਕੱਲ੍ਹ ਜਿਵੇਂ ਖ਼ਰਾਬ ਟ੍ਰੈਫਿਕ ਆਵਾਜਾਈ ਦੇ ਸਾਧਨ ਬਹੁਤ ਜ਼ਿਆਦਾ ਹੋਣ ਦੇ ਕਾਰਨ ਜੋ ਸੜਕ ਦੇ ਉੱਪਰ ਜੋ ਟ੍ਰੈਫਿਕ ਰੂਲ ਹਨ ਉਹ ਬਹੁਤ ਹੀ ਘੱਟ ਲੋਕ ਫੋਲੋ ਕਰਦੇ ਹਨ ਜਿਸ ਦੇ ਕਾਰਨ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਲੰਬਾ ਜਾਮ ਲੱਗ ਜਾਂਦਾ ਹੈ ਅਤੇ ਇਸ ਮੁਸ਼ਕਿਲ ਦੇ ਕਾਰਨ ਸਾਨੂੰ ਬਹੁਤ ਹੀ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਖ਼ਰਾਬ ਟ੍ਰੈਫਿਕ ਨਿਯਮਾਂ ਦਾ ਕਾਰਨ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ ਦੂਸਰੇ ਨੰਬਰ 'ਤੇ ਤੰਗ ਸੜਕਾਂ ਜੋ ਅੱਜ ਕੱਲ੍ਹ ਸੜਕਾਂ ਬਿਲਕੁਲ ਬਹੁਤ ਹੀ ਦੇਖਣ ਤੰਗ ਮਿਲਦੀਆਂ ਹਨ ਅਤੇ ਸਾਡੇ ਆਵਾਜਾਈ ਦੇ ਸਾਧਨ ਜ਼ਿਆਦ ਹੋਣ ਦਾ ਕਾਰਨ ਇੱਕ ਸੜਕ ਦੇ ਵਿੱਚੋਂ ਲੰਘਣ ਵਾਸਤੇ ਜੋ ਆਵਾਜਾਈ ਦੇ ਸਾਡੇ ਵੱਡੇ ਸਾਧਨ ਹਨ ਅਤੇ ਸਾਨੂੰ ਬਾਈਕਰਾਂ ਨੂੰ ਉਹਨਾਂ ਸੜਕਾਂ ਵਿੱਚੋਂ ਲੰਘਣ ਵਾਸਤੇ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਇਸ ਤਰ੍ਹਾਂ ਕਰਨਾ ਪੈਂਦਾ ਹੈ ਕਿ ਉਹਨਾਂ ਤੰਗ ਸੜਕਾਂ ਦੇ ਵਿੱਚ ਲੋਕਾਂ ਨੇ ਆਪਣੇ ਆਵਾਜਾਈ ਦੇ ਸਾਧਨ ਜਿਵੇਂ ਕਾਰਾਂ ਆਦਿ ਵਗੈਰਾ ਲਗਾਈਆਂ ਹੁੰਦੀਆਂ ਹਨ ਅਤੇ ਇਸ ਇਹ ਵੀ ਇੱਕ ਬਹੁਤ ਹੀ ਜ਼ਿਆਦਾ ਵੱਡੀਆਂ ਚੁਣੌਤੀਆਂ ਹਨ ਜਿਵੇਂ ਹੋਰ ਜੰਗਲੀ ਜਾਨਵਰ ਜਿਵੇਂ ਸੜਕ ਦੇ ਅੱਗੇ ਇਕਦਮ ਆ ਜਾਂਦੇ ਹਨ ਅਚਾਨਕ ਹੀ ਉਹਨਾਂ ਦੇ ਅੱਗੇ ਆਉਣ ਦੇ ਕਾਰਨ ਬਹੁਤ ਹੀ ਜ਼ਿਆਦਾ ਨੁਕਸਾਨ ਹੁੰਦਾ ਹੈ ਅਤੇ ਇਹਨਾਂ ਨੁਕਸਾਨਾਂ ਦਾ ਸਾਨੂੰ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੇ ਨਾਲ ਸਾਡੀ ਜੋ ਕੁਝ ਮਨੁੱਖਾਂ ਦੀ ਜੋ ਜਾਨ ਵੀ ਜਾ ਸਕਦੀ ਹੈ ਇਹ ਇਹ ਅਜਿਹੀਆਂ ਜੋ ਮੁਸ਼ਕਿਲਾਂ ਦਾ ਸਾਨੂੰ ਸਾਹਮਣਾ ਬਾਈਕਰ ਵਜੋਂ ਕਰਨਾ ਪੈਂਦਾ ਹੈ ਖ਼ਰਾਬ ਮੌਸਮ ਦੇ ਕਾਰਨ ਜ਼ਿਆਦਾ ਬਾਰਿਸ਼ ਦੇ ਕਾਰਨ ਅਜਿਹੀਆਂ ਵੱਡੀਆਂ ਚੁਣੌਤੀਆਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ